ਸਾਡੇ ਇਲਾਕੇ ਵਿੱਚ ਇਹ ਮਾਨਤਾ ਹੈ ਕਿ ਘਰੇਲੂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਿਹੜਾ ਚੇਤ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਜਿਹੜੀ ਉਸ ਦਿਨ ਸਵੇਰੇ ਜਿਹੜੀ ਪਿੰਡਾਂ ਦੀਆਂ ਔਰਤਾਂ ਉਹ ਨਾ ਘਰਾਂ ਦੇ ਬਾਹਰ ਪਸ਼ੂਆਂ ਦੇ ਗੋਹੇ ਦੇ ਨਾਲ ਆਪਣੇ ਜਾਂ ਜਿਹੜੀਆਂ ਕੰਧਾਂ ਜਾਂ ਕੌਲੇ ਹੁੰਦੇ ਆ ਉਹਨਾਂ ਦੇ ਉੱਪਰ ਇੱਕ ਖ਼ਾਸ ਕਿਸਮ ਦੇ ਫੁੱਲ ਬੂਟਿਆਂ ਦੇ ਡਿਜ਼ਾਇਨ ਬਣਾਉਂਦੀਆਂ ਜਿਹਦੇ ਨਾਲ ਇਹਦੇ 'ਚ ਇਹ ਮੰਨਿਆ ਜਾਂਦਾ ਵੀ ਅਜਿਹਾ ਕਰਨ ਨਾਲ ਜਿਹੜੇ ਪਸ਼ੂਆਂ ਨੂੰ ਹੋਣ ਵਾਲੀਆਂ ਜਿਹੜੀਆਂ ਮੌਸਮ ਦੇ ਵਿੱਚ ਮੌਸਮ ਦੀ ਤਬਦੀਲੀ ਦੇ ਨਾਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਨਹੀਂ ਲੱਗਦੀਆਂ ਅਤੇ ਸਾਡਾ ਜਿਹੜਾ ਪਸ਼ੂ ਧਨ ਆ ਉਹ ਤੰਦਰੁਸਤ ਰਹਿੰਦਾ ਤੇ ਇਹਦੇ ਨਾਲ ਹੋਰ ਵੀ ਕਈ ਜਿਵੇਂ ਪਿੰਡਾਂ 'ਚ ਦੇਸੀ ਇਲਾਜ ਵੀ ਕੀਤੇ ਜਾਂਦੇ ਆ ਜਿਵੇਂ ਪਸ਼ੂ ਜੇ ਕਰ ਉਹ ਪੱਠੇ ਨਹੀਂ ਖਾਂਦਾ ਜਾਂ ਇੱਦਾਂ ਤਾਂ ਉਹਨੂੰ ਕੋਈ ਕਈ ਕਿਸਮਾਂ ਦੇ ਕਾੜੇ ਦਿੱਤੇ ਜਾਂਦੇ ਜਿਵੇਂ ਕਾੜਾ ਇੱਕ ਦੇਸੀ ਜਿਹੜੀ ਹੈਗਾ ਇਲਾਜ ਹੈਗਾ ਇਹਦੇ ਵਿੱਚ ਇਹ ਹੁੰਦਾ ਵੀ ਪਾਣੀ ਦੇ ਵਿੱਚ ਕੋਈ ਆਪਣੀ ਦੇਸੀ ਜੜ੍ਹੀ ਬੂਟੀਆਂ ਜਾਂ ਰਸੋਈ ਦੇ ਮਸਾਲੇ ਜਿਵੇਂ ਸੌਂਫ ਅਜਵਾਇਣ ਗੂੜ੍ਹ ਆਦਿ ਨੂੰ ਉਬਾਲ ਕੇ ਅਤੇ ਪਸ਼ੂ ਨੂੰ ਉਹ ਦਿੱਤਾ ਜਾਂਦਾ ਕਿਸੇ ਪੈਪ ਦੀ ਮਦਦ ਨਾਲ ਜਿਹਨੂੰ ਪੰਜਾਬੀ ਦੇ ਵਿੱਚ ਨਾਲ ਕਹਿੰਦੇ ਆ ਉਹਦੇ ਨਾਲ ਪਸ਼ੂਆਂ ਨੂੰ ਇਹ ਕਾੜਾ ਦਿੱਤਾ ਜਾਂਦਾ ਅਤੇ ਇੱਕ ਪਸ਼ੂਆਂ ਦੇ ਵਿੱਚ ਆਮ ਹੀ ਬਿਮਾਰੀ ਹੁੰਦੀ ਹੈਗੀ ਮੂੰਹ ਖੋਰ ਦੀ ਉਹਦੇ ਵਿੱਚ ਇਹ ਕੀਤਾ ਜਾਂਦਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਹੈਗਾ ਪਸ਼ੂਆਂ ਦੇ ਥੱਲੇ ਜਿਹੜੀ ਚੂਨਾ ਕਲੀ ਹੁੰਦੀ ਹੈ ਉਹ ਖਿਲਾਰੀ ਜਾਂਦੀ ਆ ਅਤੇ ਜਿਹੜੇ ਆਪਣੇ ਘਰਾਂ ਦੀਆਂ ਦਹਲੀਜਾਂ ਜਾਂ ਪਸ਼ੂਆਂ ਦੇ ਵਾੜੇ ਨੂੰ ਜਾਣ ਵਾਲੇ ਰਸਤੇ ਦੇ ਉੱਪਰ ਉਹ ਚੂਨਾ ਕਲੀ ਖਿਲਾਰੀ ਜਾਂਦੀ ਹੈ ਇਸ ਨਾਲ ਵੀ ਇਹ ਮੰਨਿਆ ਜਾਂਦਾ ਹੈ ਕਿ ਪਸ਼ੂਆਂ ਨੂੰ ਇਹ ਮੂੰਹ ਖੋਰ ਦੀ ਜਿਹੜੀ ਬਿਮਾਰੀ ਹੈ ਇਹ ਨਹੀਂ ਲੱਗਦੀ